ਵੈਸੇ ਤਾਂ ਮੈਂ ਮਹੀਨੇ ਵਿੱਚ ਇੱਕ ਵਾਰ ਕਿਸੇ ਜਗ੍ਹਾ ਘੁੰਮਣ ਜਾਂਦੀ ਹੀ ਹਾਂ ਇਹਨਾਂ ਵਿੱਚੋਂ ਕਈ ਵਾਰ ਮੈਂ ਇਤਿਹਾਸਿਕ ਗੁਰਦੁਆਰਿਆਂ ਜਾਂ ਹਿਲ ਸਟੇਸ਼ਨ ਵਗੈਰਾ 'ਤੇ ਘੁੰਮਣ ਜਾਂਦੀ ਹਾਂ ਗੁਰਦੁਆਰੇ ਵਿੱਚ ਮੈਂ ਪਟਿਆਲੇੇ ਦੇ ਦੁੱਖ ਨਿਵਾਰਨ ਗੁਰਦੁਆਰੇ ਵਿੱਚ ਗਈ ਹੋਈ ਹਾਂ ਜਿੱਥੇ ਕਿ ਜਾ ਕੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਿੰਨੀ ਵਾਰ ਵੀ ਮੈਂ ਜਾਂਦੀ ਹਾਂ ਮੈਨੂੰ ਉੱਦਾਂ ਦਾ ਲੱਗਦਾ ਵੀ ਮੈਂ ਇੱਥੇ ਪਹਿਲੀ ਵਾਰ ਆਈ ਹਾਂ ਉੱਥੇ ਜਾ ਕੇ ਮੈਨੂੰ ਮਤਲਬ ਮੇਰਾ ਮਨ ਇੰਨਾ ਸ਼ਾਂਤ ਹੁੰਦਾ ਹੈ ਕਿ ਮੈਂ ਦੁਨੀਆ ਦੇ ਹਰ ਦੁੱਖ ਦਰਦ ਨੂੰ ਭੁੱਲ ਜਾਂਦੀ ਹਾਂ ਅਤੇ ਉਸ ਤੋਂ ਬਾਅਦ ਮੈਂ ਉੱਥੇ ਦੇ ਕਾਲੀ ਮਾਤਾ ਮੰਦਰ ਵੀ ਮੱਥਾ ਟੇਕਣ ਜ਼ਰੂਰ ਜਾਂਦੀ ਹਾਂ ਜਿੱਥੇ ਕਿ ਉਹਨਾਂ ਦਾ ਇੱਕ ਮਤਲਬ ਇਤਿਹਾਸਿਕ ਮੂਰਤੀ ਬਣਾਈ ਗਈ ਹੈ ਉਹਨਾਂ ਵੱਲ ਦੇਖ ਕੇ ਤੁਹਾਨੂੰ ਇੱਕ ਪੋਜੀਟਿਵ ਐਨਰਜੀ ਮਿਲਦੀ ਹੈ ਅਤੇ ਉੱਥੇ ਧਿਆਨ ਲਗਾ ਕੇ ਵੀ ਤੁਹਾਡਾ ਮਨ ਸ਼ਾਂਤ ਹੁੰਦਾ ਹੈ ਅਤੇ ਹੋਰ ਹਿੱਲ ਸਟੇਸ਼ਨ ਜਿਵੇਂ ਕਿ ਮੈਂ ਆਪਣਾ ਮਨਾਲੀ ਵਗੈਰਾ ਵੀ ਜਾਂਦੀ ਹਾਂ ਉੱਥੇ ਦਾ ਵਿਊ ਮੈਨੂੰ ਬਹੁਤ ਵਧੀਆ ਲੱਗਦਾ ਹੈ ਉੱਥੇ ਦਾ ਮੌਸਮ ਵੀ ਬਹੁਤ ਵਧੀਆ ਹੁੰਦਾ ਹੈ ਉੱਥੇ ਦੇ ਲੋਕ ਵੀ ਬਹੁਤ ਵਧੀਆ ਹਨ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਹੈ ਉਹ ਆਏ ਹੋਏ ਲੋਕਾਂ ਦਾ ਸਵਾਗਤ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਹਨ